ਸਤਿ ਸ਼੍ਰੀ ਅਕਾਲ ਜੀ ਮੈਨੂੰ ਗਾਇਕੀ ਦਾ ਹੀ ਮੁੱਢ ਤੋਂ ਬਹੁਤ ਹੀ ਸ਼ੌਕ ਹੈ ਅਤੇ ਮੈਨੂੰ ਛੋਟੇ ਹੁੰਦਿਆਂ ਹੀ ਗਾਇਕੀ ਗਾਉਣ ਦਾ ਬਹੁਤ ਹੀ ਸ਼ੌਕ ਹੋ ਗਿਆ ਉਸ ਸਮੇਂ ਮੈਨੂੰ ਗਾਇਕੀ ਸਿਖਾਉਣ ਨਾ ਦਾ ਕੋਈ ਵੀ ਨਾ ਤਾਂ ਸਾਡੇ ਘਰੇ ਹੀ ਨਾ ਹੀ ਆਂਢ ਗੁਆਂਢ ਵਿੱਚ ਅਤੇ ਨਾ ਹੀ ਟੀਚਰ ਅਤੇ ਨਾ ਹੀ ਮਿਊਜਿਕ ਸੀ ਅਤੇ ਗਾਇਕੀ ਵਿੱਚ ਮੈਨੂੰ ਬਹੁਤ ਅਤੇ ਸਾਡੇ ਘਰ ਗਾਇਕੀ ਪੁਰਾਣੇ ਸਮੇਂ ਵਿੱਚ ਘਰ ਦੇ ਲੋਕ ਹਾਂ ਗਾਇਕੀ ਗੌ ਗਾਉਣਾ ਪਸੰਦ ਨਹੀਂ ਸੀ ਕਰਦੇ ਸਨ ਅਤੇ ਕੁੜੀਆਂ ਨੂੰ ਤਾਂ ਖਾਸ ਕਰਕੇ ਅਤੇ ਜਿਹੜੀ ਵੀ ਕੋਈ ਗਾਉਂਦਾ ਸੀ ਤਾਂ ਉਹਨਾਂ ਨੂੰ ਸਜ਼ਾ ਹੀ ਦਿੱਤੀ ਜਾਂਦੀ ਸੀ ਇਸ ਲਈ ਮੇਰਾ ਸ਼ੌਕ ਅਧੂਰਾ ਹੀ ਰਹਿ ਗਿਆ ਅਤੇ ਸ ਅਧੂਰਾ ਹੀ ਰਹਿ ਗਿਆ ਅਤੇ ਹੁਣ ਹੁਣ ਮੈਂ ਮੈਂ ਆਪਦੇ ਆਪ ਮੂੰਹ ਵਿੱਚ ਗਾਉਂਦੀ ਹੀ ਰਹੀ ਅਤੇ ਮੈਨੂੰ ਅਤੇ ਮੈਂ ਵੱਡੇ ਹੋ ਕੇ ਹਾਂ ਕਾਲਜਾਂ ਵਿੱਚ ਜਦੋਂ ਗਈ ਤਾਂ ਉੱਥੇ ਹੀ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਮੈਂ ਆਪਦੀ ਮਿਊਜਿਕ ਨੂੰ ਆਪ ਹੀ ਪ੍ਰਤੀਕ ਕੀਤਾ ਅਤੇ ਪ੍ਰਤੀਕ ਕੀਤਾ ਅਤੇ ਉਸ ਸਮੇਂ ਸਾਡੇ ਹਾਂ ਮੈਂ ਆਪਦੇ ਆਪ ਹੀ ਇੱਕ ਗਾਉਣ ਇੱਕ ਅਲੱਗ ਤੋਂ ਹੀ ਮਿਊਜਿਕ ਟੀਚਰ ਰੱਖੀ ਉੱਥੇ ਹਾਂ ਅਤੇ ਮੈਨੂੰ ਅਤੇ ਉਸ ਵਿੱਚ ਮੈਂ ਫੈਸਟੀਵਲਾਂ ਵਿੱਚ ਬਹੁਤ ਭਾਗ ਲਿਆ ਅਤੇ ਉੱਥੇ ਹੀ ਮ ਲੋ ਹਾਂ ਜਦੋਂ ਮੈਂ ਗੀਤ ਸੌਂਗ ਗੀਤ ਗਾਇਆ ਤਾਂ ਓਥੇ ਹੀ ਸਾਰਿਆਂ ਨੇ ਤਾੜੀ ਵਜਾ ਕੇ ਮੇਰਾ ਸਵਾਗਤ ਕੀਤਾ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਮੈਂ ਆਪਦੀ ਗਾਇਕੀ ਆਪ ਹੀ ਗਾਉਣਾ ਹੀ ਸਿੱਖੀ ਸੀ ਅਤੇ ਸਾਡੇ ਕਹਿੰਦੇ ਅਤੇ ਮੈਨੂੰ ਉਸ ਸਮੇਂ ਮੇਰਾ ਗਾਇਕੀ ਕਰਨ ਦਾ ਸ਼ੌਕ ਹੀ ਪੂਰਾ ਹੋ ਗਿਆ